ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਸਾ ਰੇ ਗਾ ਮਾ ਮਿਊਜ਼ਿਕ ਅਕੈਡਮੀ ਤੋਂ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਵੈਸੇ ਤਾਂ ਮਤਲਬ ਮੈਂ ਐਜ ਆ ਟੀਚਰ ਕੰਮ ਕਰਦੀ ਹਾਂ ਜੀ ਕੋਲੇਜ ਵਿੱਚ ਵੀ ਕੰਮ ਕਰਦੀ ਹਾਂ ਅਤੇ ਨਾਲ਼ ਨਾਲ਼ ਸਾਡੀ ਜਿਹੜੀ ਅਕੈਡਮੀ ਹੈ ਸਾ ਰੇ ਗਾ ਮਾ ਉਹਦੇ ਵਿੱਚ ਵੀ ਕੰਮ ਕਰਦੀ ਹਾਂ ਅਤੇ ਜੇ ਵੈਸੇ ਆਪਾਂ ਗਾਇਕਾਂ ਦੀ ਗੱਲ ਕਰੀਏ ਤਾਂ ਆਪਣੇ ਹੈ ਨਾ ਗੁਰਦਾਸ ਮਾਨ ਸਾਹਿਬ ਜੀ ਹੋ ਗਏ ਦਲੇਰ ਮਹਿੰਦੀ ਹੋ ਗਏ ਓਲਡ ਪੰਜਾਬ ਦੇ ਸਿੰਗਰ ਹੈ ਨਾ ਅਤੇ ਜਗਜੀਤ ਸਿੰਘ ਜੀ ਹੋ ਗਏ ਗਜ਼ਲਾਂ ਦੇ ਲਈ ਫੇਮਸ ਨੇ ਅਤੇ ਜੇ ਆਪਾਂ ਲੇਟੈਸਟ ਗੱਲ ਕਰੀਏ ਫਿਰ ਆਪਣਾ ਦਲਜੀਤ ਦੋਸਾਂਝ ਹੋ ਗਏ ਅਮਰਿੰਦਰ ਗਿੱਲ ਹੋ ਗਏ ਸਤਿੰਦਰ ਸਰਤਾਜ ਹੋ ਗਏ ਤੁਸੀਂ ਇਹਨਾਂ ਦੇ ਜਿਹੜੇ ਮਤਲਬ ਗਾਣੇ ਨੇ ਜਾਂ ਲਿਖਤਾਂ ਨੇ ਤੁਸੀਂ ਉਹਨਾਂ ਨੂੰ ਸਪੋਟੀਫਾਈ 'ਤੇ ਵੀ ਸੁਣ ਸਕਦੇ ਯੂਟੀਊਬ 'ਤੇ ਵੀ ਸੁਣ ਸਕਦੇ ਅਤੇ ਬਾਕੀ ਤਾਂ ਆਪਾਂ ਨੂੰ ਗੂਗਲ ਦੇ ਦਿੰਦਾ ਅੱਜ ਕੱਲ੍ਹ ਹਰ ਜਗ੍ਹਾ 'ਤੇ ਅਵੇਲੇਬਲ ਹੈ ਸਾਡੇ ਕੋਲ ਸਮਾਰਟ ਫ਼ੋਨ ਵੀ ਨੇ ਅਤੇ ਹੋਰ ਸਰ ਹਾਂਜੀ ਮੈਂ ਉਸੀ 'ਤੇ ਆਉਣ ਲੱਗੀ ਸੀ ਹਾਂਜੀ ਹਾਂਜੀ ਅਤੇ ਇੰਸਟਰੂਮੈਂਟ ਫਿਰ ਸਾਡੇ ਜਿਹੜੇ ਅਕੈਡਮੀ ਦੇ ਸਟੂਡੈਂਟਸ ਨੇ ਅਸੀਂ ਉਹਨਾਂ ਨੂੰ ਰਿਕਮੈਂਡ ਕਰਦੇ ਹਾਂ ਪਟਿਆਲੇ ਵਿੱਚ ਫੇਮਸ ਨੇ ਬਹੁਤ ਜ਼ਿਆਦਾ ਨਾਗੀ ਇੰਸਟਰੂਮੈਂਟਸ ਉਹਨਾਂ ਤੋਂ ਲਓ ਅਤੇ ਉਹਨਾਂ ਉਹਨਾਂ ਦੀ ਟਿਊਨਿੰਗ ਬਹੁਤ ਵਧੀਆ ਕੀਤੀ ਹੁੰਦੀ ਹੈ ਅੱਛੀ ਕੁਆਲਿਟੀ ਦੇ ਵਿੱਚ ਬੈਸਟ ਪ੍ਰਾਈਜਿਜ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਨੇ ਨਾਲ਼ੇ ਇੰਟਰਨੈਸ਼ਨਲੀ ਅਵੇਲੇਬਲ ਨੇ ਉਹ ਅਤੇ ਉਸ ਤੋਂ ਬਾਅਦ ਤੁਸੀਂ ਇੰਟਰਸਟਿਡ ਹੋ ਸਰ ਅਕੈਡਮੀ ਵਿੱਚ ਅ ਖੁਦ ਸਿੱਖਣ ਲਈ ਹਾਂਜੀ ਮੈਂ ਤੁਹਾਨੂੰ ਜਿਵੇਂ ਕਿ ਦੱਸ ਰਹੀ ਸੀ ਵੀ ਸਾਡੀ ਆਵਦੀ ਵੀ ਅਕੈਡਮੀ ਹੈ ਸਾ ਰੇ ਗਾ ਮਾ ਮਿਊਜ਼ਿਕ ਅਕੈਡਮੀ ਅਤੇ ਉਹਦੇ ਵਿੱਚ ਅਸੀਂ ਫਿਫਥ ਕਲਾਸ ਤੋਂ ਲੈ ਕੇ ਮੰਨ ਲਉ ਜਿੰਨੇ ਵੀ ਥਰਟੀ ਥਰਟੀ ਫਾਈਵ ਦੀ ਏਜ਼ ਤੱਕ ਦੇ ਬੱਚੇ ਜਾਂ ਹੋਰ ਹਾਂਜੀ ਸਿੱਖਣਾ ਚਾਹੁੰਦੇ ਨੇ ਮਿਊਜ਼ਿਕ ਅਸੀਂ ਸਿਖਾਉਂਦੇ ਹਾਂ ਹਰ ਤਰੀਕੇ ਦਾ ਇੰਸਟਰੂਮੈਂਟਲ ਵੋਕਲ ਹਾਂਜੀ ਠੀਕ ਹੈ ਜੇ ਫ਼ੀਸ ਸਟਕਚਰ ਸਰ ਤੁਹਾਨੂੰ ਚਾਹੀਦਾ ਹੋਵੇ ਤਾਂ ਤਾਂ ਮੈਂ ਤਾਂ ਮੈਂ ਤੁਹਾਨੂੰ ਇਸ ਨੰਬਰ 'ਤੇ ਵੱਟਸਅੱਪ ਕਰ ਦਾਂਗੀ ਹਾਂਜੀ ਹਾਂਜੀ ਥੈਂਕ ਯੂ